ਹੈਲੋ ਤੁਸੀਂ ਡਿਲੀਵਰੀ ਵਾਲੇ ਗੱਲ ਕਰ ਰਹੇ ਹੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਮੈਂ ਸਵਿੱਗੀ 'ਤੇ ਖਾਣਾ ਬੁੱਕ ਕੀਤਾ ਸੀ ਅਤੇ ਮੈਂ ਤੁਹਾਨੂੰ ਇਹ ਪੁੱਛਣ ਲਈ ਫੋਨ ਕੀਤਾ ਹੈ ਕਿ ਮੈਂ ਜਿਹੜਾ ਪਤਾ ਤੁਹਾਨੂੰ ਦਿੱਤਾ ਹੈ ਕੀ ਉਸ ਬਾਰੇ ਤੁਹਾਨੂੰ ਪੂਰਾ ਪੱਕਾ ਪਤਾ ਹੈ ਕਿ ਕਿੱਥੇ ਆਡਰ ਡਿਲੀਵਰੀ ਕਰਨਾ ਹੈ ਸ਼ਾਇਦ ਸਾਈਡ ਉੱਪਰ ਮੈਂ ਆਪਣਾ ਡਰੈਸ ਦਿੱਤਾ ਹੈ ਲੇਕਿਨ ਮੈਂ ਤੁਹਾਨੂੰ ਖ਼ਾਸ ਨਿਰਦੇਸ਼ ਦੇਣਾ ਚਾਹੁੰਦਾ ਹਾਂ ਕਿ ਮੇਰਾ ਜਿਹੜਾ ਘਰ ਹੈ ਉਹ ਪਿੰਡ ਦੇ ਪੱਛਮ ਵਾਲੇ ਪਾਸੇ ਸਥਿਤ ਹੈ ਅਤੇ ਉਸਦੇ ਨੇੜੇ ਗੁਰਦੁਆਰਾ ਬਾਬਾ ਸ਼੍ਰੀ ਚੰਦ ਜੀ ਹੈ ਉਸ ਦੇ ਨਾਲ ਵਾਲੀ ਗਲੀ ਵਿੱਚ ਦੇ ਅੰਦਰ ਜਾ ਕੇ ਪਚਵੰਜਾ ਨੰਬਰ ਮੇਰੇ ਘਰ ਦਾ ਨੰਬਰ ਹੈ ਬਿਲਕੁਲ ਸਰਪੰਚ ਸਾਹਿਬ ਜੀ ਦੇ ਘਰ ਦੇ ਸਾਹਮਣੇ ਮੇਰਾ ਘਰ ਹੈ ਉੱਥੇ ਪਹੁੰਚ ਕੇ ਤੁਸੀਂ ਮੈਨੂੰ ਫੂਨ ਕਰ ਲੈਣਾ ਅਤੇ ਮੈਂ ਆਪਣਾ ਅਡ ਆਡਰ ਤੁਹਾਡੇ ਕੋਲੋਂ ਲੈ ਲਵਾਂਗਾ ਤਾਂ ਜੋ ਤੁਹਾਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਮੈਂ ਆਪਣਾ ਆਡਰ ਸਹੀ ਸਮੇਂ 'ਤੇ ਲੈ ਸਕਾਂ ਮੈਂ ਤੁਹਾਨੂੰ ਇਹ ਵੀ ਦੱਸਣ ਲਈ ਫੋਨ ਕੀਤਾ ਹੈ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ